ਹਰੇਕ ਘਰ ਵਿੱਚ ਹਰ ਇੱਕ ਦੇ ਤ ਤਰੀਕੇ ਅਲੱਗ ਅਲੱਗ ਹੁੰਦੇ ਆ ਕੋਈ ਕਿਵੇਂ ਬਣਾਉਂਦਾ ਚਾਹ ਕੋਈ ਕਿਵੇਂ ਬਣਾਉਂਦਾ ਪਰ ਅਸੀਂ ਆਪਣੀ ਚਾਹ ਆਪਣੇ ਅਨੁਸਾਰ ਬਣਾਉਂਦੇ ਹਾਂ ਜਿਵੇਂ ਕਿ ਪਾਣੀ ਪਾ ਲਿਆ ਪਹਿਲਾਂ ਟੋਪ 'ਚ ਪਾ ਕੇ ਪਾਣੀ ਗੈਂਸ 'ਤੇ ਗਰਮ ਰੱਖਤਾ ਗਰਮ ਕਰਕੇ ਉਬਾਲ ਕੇ ਚੰਗੀ ਤਰ੍ਹਾਂ ਫਿਰ ਉਸ ਵਿੱਚ ਇਲਾਇਚੀ ਲੌਂਗ ਪਾ ਦਿੱਤੇ ਜਦੋਂ ਉੱਬਲ ਕੇ ਉਬਾਲਣ ਤੋਂ ਬਾਅਦ ਪੱਤੀ ਪਾਤੀ ਪੱਤੀ ਨੂੰ ਚੰਗੀ ਤਰਾਂ ਉਬਾਲ ਲਿਆ ਉਬਾਲਣ ਤੋਂ ਬਾਅਦ ਫਿਰ ਖੰਡ ਪਾਤੀ ਖੰਡ ਉਬਾਲ ਲਈ ਉਹ ਚੰਗੀ ਤਰ੍ਹਾਂ ਉਬਾਲ ਲਿਆ ਸਾਰਾ ਕੁਛ ਉਬਾਲ ਕੇ ਫਿਰ ਉਸ ਤੋਂ ਬਾਅਦ ਕਿ ਥੋੜ੍ਹੇ ਟਾਈਮ ਬਾਅਦ ਦੁੱਧ ਪਾਇਆ ਦੁੱਧ ਨੂੰ ਚੰਗੀ ਤਰ੍ਹਾਂ ਉਬਾਲਾ ਲਾਇਆ ਤਿੰਨ ਚਾਰ ਉਬਾਲੇ ਲਾਏ ਉਬਾਲਣ ਤੋਂ ਬਾਅਦ ਫਿਰ ਉਸਨੂੰ ਚੰਗੀ ਤਰ੍ਹਾਂ ਉਬਾਲ ਕੇ ਠੰਢਾ ਕੀਤਾ ਫਿਰ ਚਾਹ ਬਣਾਈ ਚਾਹ ਬਹੁਤ ਵਧੀਆ ਬਣੀ ਪੀ ਕੇ ਫਿਰ ਟੇਸਟ ਟੇਸਟ ਕੀਤੀ ਸਾਰਿਆਂ ਨੇ ਸਾਰੇ ਕਹਿਣ ਲੱਗੇ ਚਾਹ ਬਹੁਤ ਵਧੀਆ ਬਣਾਈ ਆ ਕਿਸ ਕਿਸ ਕਿਵੇਂ ਬਣਾਈ ਆ ਫਿਰ ਦੱਸਣ ਲੱਗੇ ਅਸੀਂ ਵੀ ਆਏ ਬਣਾਈ ਆ ਸਾਰਿਆਂ ਨੇ ਚਾਹ ਦੀ ਪ੍ਰਸ਼ੰਸ਼ਾ ਕੀਤੀ ਚਾਹ ਪੀ ਕੇ ਮਨ ਖੁਸ਼ ਹੋ ਗਿਆ ਸਭ ਦਾ